ਇਹਦੇ 'ਚ ਖ਼ਤਰਾ ਵਧਿਆ ਰਹਿੰਦਾ ਹੈ ਕਿ ਮੈਂ ਕੁਛ ਜ਼ਿਆਦਾ ਨਹੀਂ ਜਾਣਦੀ ਸ਼ੇਅਰ ਮਾਰਕੀਟ ਬਾਰੇ ਸ਼ੇਅਰ ਮਾਰਕੀਟ 'ਚ ਜੇ ਆਪਾਂ ਪੈਸਾ ਲਗਾਈਏ ਤਾਂ ਵੱਧ ਵੀ ਸਕਦਾ ਹੈ ਪੰਜ ਰੁਪਏ ਲਗਾਈਏ ਤਾਂ ਹੋਰ ਪੰਜ ਹਜ਼ਾਰ ਵੀ ਹੋ ਸਕਦਾ ਦਸ ਹਜ਼ਾਰ ਵੀ ਹੋ ਸਕਦਾ ਪਰ ਜੇ ਨਾ ਵੀ ਲਗਾਈਏ ਤਾਂ ਵੀ ਆਪਾਂ ਨੂੰ ਕੋਈ ਖ਼ਤਰਾ ਨਹੀਂ ਹੈਗਾ ਜੇ ਲਗਾਉਂਦੇ ਹਾਂ ਤਾਂ ਜ਼ਿਆਦਾ ਖ਼ਤਰਾ ਰਹਿੰਦਾ ਹੈ ਇਸ ਲਈ ਆਪਾਂ ਨੂੰ ਸ਼ੇਅਰ ਮਾਰਕੀਟ ਤੋਂ ਥੋੜ੍ਹਾ ਜਿਹਾ ਦੂਰ ਰਹਿਣਾ ਚਾਹੀਦਾ ਹੈ ਅਤੇ ਜੋ ਵੀ ਇਹਦੇ ਵਿੱਚ ਆਪਾਂ ਲਗਾਉਂਦੇ ਹਾਂ ਆਪਾਂ ਇਹ ਨਹੀਂ ਪਤਾ ਕੋਈ ਔਨਲਾਈਨ ਬੈਠਾ ਲਗਾਈ ਜਾਂਦਾ ਕੋਈ ਕਿਵੇਂ ਲਗਾਈ ਜਾਂਦਾ ਤਾਂ ਇਹਦਾ ਇਹ ਨਹੀਂ ਪਤਾ ਕਿ ਵਾਪਿਸ ਆਉਣ ਚਾਹੇ ਨਾ ਆਉਣ ਜੇ ਆ ਜਾਣ ਤਾਂ ਲੱਖਾਂ 'ਚ ਵੀ ਹੋ ਸਕਦਾ ਬੰਦਾ ਅਤੇ ਅਰਸ਼ਾਂ ਤੋਂ ਫਰਸ਼ਾਂ 'ਤੇ ਵੀ ਚੜ੍ਹ ਸਕਦਾ ਹੈ ਜੇ ਨਾ ਆਏ ਤਾਂ ਫਿਰ ਸਮਝੋ ਡੁੱਬੇ ਅਤੇ ਡੁੱਬੇ ਪੈਸੇ ਸ਼ੇਅਰ ਮਾਰਕੀਟ 'ਚ ਸ਼ੇਅਰ ਮਾਰਕੀਟ 'ਤੇ ਜਿਹੜੀ ਇਹ ਦੂਜੀਆਂ ਐਪ ਹੈ ਡਿਜਿਟਲ ਐਪ ਹੈ ਇਨ੍ਹਾਂ ਨੇ ਆਪਾਂ ਨੂੰ ਬਹੁਤ ਬਦਲਿਆ ਹੈ ਇਹਨਾਂ 'ਤੇ ਘਰ ਬੈਠੇ ਆਪਾਂ ਕੋਈ ਵੀ ਚੀਜ਼ ਮੰਗਵਾ ਸਕਦੇ ਹਾਂ ਆਪਾਂ ਨੂੰ ਕੋਈ ਵੀ ਚੀਜ਼ ਆਸਾਨੀ ਨਾਲ ਪ੍ਰਾਪਤ ਹੋ ਜਾਂਦੀ ਹੈ ਅਤੇ ਆਪਾਂ ਜੋ ਵੀ ਲੈਂਦੇ ਹਾਂ ਉਨ੍ਹਾਂ 'ਚ ਮੁਨਾਫ਼ਾ ਵੀ ਹੈ ਅਤੇ ਘਾਟਾ ਵੀ ਹੈ ਇਸ ਲਈ ਕਈ ਵਾਰ ਚੀਜ਼ ਵਧੀਆ ਆ ਜਾਂਦੀ ਹੈ ਕਈ ਵਾਰ ਖ਼ਤਰਨਾਕ ਆ ਜਾਂਦੀ ਹੈ ਇਹਨਾਂ ਚੀਜ਼ 'ਚ ਬਹੁਤ ਖ਼ਤਰਾ ਵੀ ਹੈ ਅਤੇ ਸੁਵ ਸੁਵਿਧਾਇਕ ਵੀ ਹੈ ਸੁਵਿਧਾ ਵੀ ਮਿਲਦੀ ਹੈ ਚੰਗੀਆਂ ਇਸ ਲਈ ਸੋਚ ਸਮਝ ਕੇ ਸਾਨੂੰ ਸ਼ੇਅਰ ਮਾਰਕਿਟ 'ਤੇ ਪੈਸਾ ਖਰਚ ਕਰਨਾ ਚਾਹੀਦਾ ਜਾਂ ਤਾਂ ਲਗਾਓ ਸੋਚ ਸਮਝ ਕੇ ਲਗਾਓ ਜੇ ਨਹੀਂ ਲਗਾਇਆ ਤਾਂ ਬਹੁਤ ਚੰਗੀ ਗੱਲ ਹੈ ਸ਼ੇਅਰ ਮਾਰਕੀਟ ਦਾ ਬਹੁਤ ਖ਼ਤਰਾ ਵੀ ਹੈ ਅਤੇ ਫ਼ਾਇਦਾ ਵੀ ਹੈ ਦੋਨਾਂ ਚੀਜ਼ਾਂ 'ਚੋਂ ਸਾਨੂੰ ਦੇਖ ਕੇ ਮੁਨਾਫ਼ੇ ਦਾ ਅਤੇ ਫ਼ਾਇਦੇ ਦਾ ਫਿਰ ਆਪਾਂ ਨੂੰ ਜੂਸ ਕਰਨਾ ਚਾਹੀਦਾ